ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਕੰਪਨੀ ਤੋਂ ਪੰਦਰਾਂ ਜੂਨ ਨੂੰ ਆਰਡਰ ਮੰਗਵਾਇਆ ਸੀ ਅਤੇ ਜਦੋਂ ਲੜਕਾ ਮੈਨੂੰ ਆਰਡਰ ਦੇਣ ਆਇਆ ਤਾਂ ਉਹ ਮੈਨੂੰ ਗਲਤ ਇਸ਼ਾਰੇ ਕਰ ਰਿਹਾ ਸੀ ਇਸ ਸੰਬੰਧ ਵਿੱਚ ਮੈਂ ਸ਼ਿਕਾਇਤ ਕਰਨਾ ਚਾਹੁੰਦਾ ਹਾਂ ਕਿਉਂਕਿ ਮੈਂ ਵਧੀਆ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ ਅਤੇ ਇਸ ਲਈ ਮੈਂ ਚਾਹੁੰਦਾ ਹਾਂ ਕਿ ਇਸ ਕੋਈ ਕੋਈ ਕਾਰਵਾਈ ਕੀਤੀ ਜਾਵੇ